ਅਸੀਂ ਹਰ ਤਰਾਂ ਦੇ ਪੌਦੇ ਉਗਾਉਣ ਦੇ ਸ਼ੌਕੀਨ ਹੈ ਅਸੀਂ ਫੁੱਲ ਫੁੱਲ ਆ ਜਿਹੜੇ ਫੁੱਲ ਤਾਂ ਅਸੀਂ ਉਗਾਉਂਦੇ ਹਾਂ ਵੀ ਸਾਨੂੰ ਵਧੀਆ ਲੱਗੇ ਦੇਖਣ ਨੂੰ ਔਰ ਅਤੇ ਬਾਕੀ ਜਿਹੜੇ ਫਲ਼ ਹੈ ਫਲ਼ ਅਸੀਂ ਤਾਂ ਉਗਾਉਂਦੇ ਹਾਂ ਵੀ ਸਾਨੂੰ ਤਾਜੇ ਫਲ਼ ਆਪ ਮਿਲਣ ਬਿਨਾਂ ਸਪਰੇਅ ਤੋਂ ਮਿਲਣ ਫਲ਼ਾਂ ਵਿੱਚ ਅਸੀਂ ਅੰਬ ਮਸੰਮੀ ਸੰਤਰਾ ਅਤੇ ਨਿੰਬੂ ਵਗੈਰਾ ਵੀ ਸ਼ਕੰਜਵੀ ਲਈ ਅਸੀਂ ਉਗ ਉਗਾਉਂਦੇ ਹਾਂ ਸਬਜ਼ੀਆਂ ਵਿੱਚ ਅਸੀਂ ਸਰਦੀਆਂ ਵਿੱਚ ਸਬਜ਼ੀਆਂ ਜਿਹੜੀਆਂ ਅਸੀਂ ਉਹਨਾਂ ਵਿੱਚ ਅਸੀਂ ਗੋਭੀ ਬੰਦ ਗੋਭੀ ਅਤੇ ਮੂਲੀਆਂ ਪਾਲਕ ਸਰ੍ਹੋਂ ਧਨੀਆਂ ਸਾਗ ਵਗੈਰਾ ਬੀਜਦੇ ਹਾਂ ਨਾਲ ਮੇਥੇ ਚਕੰਦਰ ਵੀ ਸਰਦੀਆਂ 'ਚ ਪੈਦਾ ਕਰਦੇ ਹਾਂ ਅਤੇ ਗਰਮੀਆਂ ਦੀਆਂ ਜਿਹੜੀਆਂ ਸਬਜ਼ੀਆਂ ਅਸੀਂ ਉਹਨਾਂ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਜਿਵੇਂ ਕੱਦੂ ਨੇ ਅਤੇ ਆਪਣੇ ਰਾਮ ਤੋਰੀ ਵਗੈਰਾ ਹੈ ਉਹ ਸਾਰੀਆਂ ਅਸੀਂ ਆਪ ਕਰਦੇ ਹਾਂ ਤਿਆਰ ਅਤੇ ਗਰਮੀਆਂ 'ਚ ਵੀ ਮੂਲੀ ਅਸੀਂ ਗਰਮੀਆਂ ਦੀ ਮੂਲੀ ਵੀ ਤਿਆਰ ਕਰਦੇ ਹਾਂ ਜਿਵੇਂ ਸਰਦੀਆਂ 'ਚ ਤਿਆਰ ਹੁੰਦੀ ਆ ਗਰਮੀਆਂ 'ਚ ਵੀ ਅਸੀਂ ਉਹਨੂੰ ਕਰਦੇ ਹਾਂ ਤਿਆਰ ਬਾਕੀ ਗਰਮੀਆਂ ਵਿੱਚ ਅਸੀਂ ਖੀਰੇ ਵੀ ਲਾਉਂਦੇ ਹਾਂ ਕਰੇਲੇ ਦੀ ਸਬਜ਼ੀ ਵੀ ਗਰਮੀਆਂ 'ਚ ਵਧੀਆ ਲੱਗਦੀ ਹੈ ਅਤੇ ਉਹ ਵੀ ਅਸੀਂ ਅ ਆਪ ਬੀਜਦੇ ਹਾਂ ਕੁਝ ਚੀਜ਼ਾਂ ਅਸੀਂ ਵੱਟਾਂ 'ਤੇ ਲਾਉਂਦੇ ਹਾਂ ਅਤੇ ਕੁਝ ਚੀਜ਼ਾਂ ਅਸੀਂ ਜਿਵੇਂ ਬੈਡ ਟਾਇਪ ਤਿਆਰ ਕਰਕੇ ਲਾਉਂਦੇ ਹਾਂ ਕੁਝ ਅਸੀਂ ਕਿਆਰੀਆਂ ਵਿੱਚ ਤਿਆਰ ਕਰਦੇ ਹਾਂ ਅਤੇ ਸਪਰੇਅ ਅਸੀਂ ਬਹੁਤ ਇਹਨਾਂ 'ਤੇ ਘੱਟ ਬਹੁਤ ਕਰਦੇ ਹਾਂ ਕਿਉਂਕਿ ਸਪਰੇਅ ਵਾਲੀਆਂ ਸਬਜ਼ੀਆਂ ਜਿਹੜੀਆਂ ਜ਼ਿਆਦਾ ਨੁਕਸਾਨਦੇਹ ਨੇ ਅਤੇ ਇੱਦਾਂ ਅਸੀਂ ਇਹ ਚੀਜ਼ਾਂ ਸਾਰੀਆਂ ਤਿਆਰ ਕਰਦੇ ਹਾਂ